ਪੰਜਾਬ ਦਾ ਸੱਭਿਆਚਾਰ ਇਹਦੇ ਇਤਿਹਾਸ ਨਾਲ ਜੁੜਿਆ ਹੋਇਆ ਹੈ ਪੰਜਾਬ ਇੰਨਵੇਡਰਸ ਦਾ ਸਥਾਨ ਰਿਹਾ ਹੈ ਜਿਹੜਾ ਵੀ ਇੱਧਰ ਆਉਂਦਾ ਸੀ ਉਹ ਇੱਥੇ ਲੜਾਈ ਕਰਦਾ ਸੀ ਇੱਥੋਂ ਅੱਗੇ ਵੱਧਦਾ ਸੀ ਦਿੱਲੀ ਤੱਕ ਵਾਪਸ ਫਿਰ ਇੱਥੋਂ ਹੀ ਜਾਂਦਾ ਸੀ ਇੱਥੋਂ ਦੇ ਲੋਕਾਂ ਨਾਲ ਲੜਦਾ ਸੀ ਜਿਹੜੇ ਇੱਥੋਂ ਦੀ ਧਰਤੀ ਤੋਂ ਇੱਥੋਂ ਦੋ ਲੋਕਾਂ ਦੇ ਬਹਾਦਰੀ ਤੋਂ ਪ੍ਰਭਾਵਿਤ ਹੁੰਦੇ ਸਨ ਉਹਨਾਂ ਵਿੱਚੋਂ ਬਹੁਤ ਲੋਕ ਚਲੇ ਵੀ ਜਾਂਦੇ ਸਨ ਪਰ ਕੁਝ ਲੋਕ ਇੱਥੇ ਰਹਿ ਜਾਂਦੇ ਸਨ ਉਹ ਜਿਹੜੇ ਲੋਕ ਇੱਥੇ ਰਹਿੰਦੇ ਸਨ ਉਹਨਾਂ ਨੇ ਆਪਣਾ ਇਤਿਹਾਸ ਵੀ ਨਾਲ ਰੱਖਿਆ ਉਹਨਾਂ ਨੇ ਆਪਣੀ ਸੰਸਕ੍ਰਿਤੀ ਨੂੰ ਵੀ ਲਿਆਂਦਾ ਉਹ ਇੱਥੋਂ ਦੀ ਸੰਸਕ੍ਰਿਤੀ ਵਿੱਚ ਘੁਲੇ ਮਿਲੇ ਵੀ ਇਹਨਾਂ ਨੂੰ ਬਹੁਤ ਕੁਝ ਦਿੱਤਾ ਵੀ ਅਤੇ ਇਹਨਾਂ ਤੋਂ ਬਹੁਤ ਕੁਝ ਲਿਆ ਵੀ ਮੈਂ ਪੰਜਾਬ ਦਾ ਇਤਿਹਾਸ ਪੰਜਾਬ ਦਾ ਸੱਭਿਆਚਾਰ ਇਸ ਦੇ ਭੂਗੋਲ ਤੋਂ ਹੀ ਪ੍ਰਭਾਵਿਤ ਹੋਇਆ ਹੈ ਕਿਉਂਕਿ ਪੰਜ ਦਰਿਆਵਾਂ ਦੀ ਧਰਤੀ ਹੈ ਪਾਣੀ ਨਾਲ ਜੁੜੀ ਹੋਈ ਧਰਤੀ ਹੈ ਇੱਥੋਂ ਦੀ ਪ੍ਰੋਡਕਸ਼ਨ ਇੱਥੋਂ ਦੇ ਰਹਿਣ ਵਾਲੇ ਲੋਕ ਇੱਕ ਦੁਜੇ ਨੂੰ ਇਸ ਧਰਤੀ ਤੋਂ ਹੀ ਪ੍ਰਭਾਵਿਤ ਕਰਦੇ ਹਨ ਇੱਥੋਂ ਦਾ ਕਲਚਰ ਵੀ ਇਸ ਧਰਤੀ ਤੋਂ ਹੀ ਪ੍ਰਭਾਵਿਤ ਹੈ